ਰਾਜ ਵਿੱਚ ਮੁੱਖ ਧਾਰਮਿਕ ਸਥਾਨ ਗੁਰਦੁਆਰਾ ਮੰਦਰ ਮਸਜਿਦ ਚਰਚ ਮੱਠ ਆਦਿ ਹਨ ਅਤੇ ਸਾਡੇ ਤਰਨ ਤਾਰਨ ਸਾਹਿਬ ਵਿੱਚ ਜਿਹੜੇ ਆ ਇਹਨੂੰ ਸਿੱਖ ਇਤਿਹਾਸ ਵਿੱਚ ਇਹਦਾ ਖ਼ਾਸ ਦਰਜਾ ਹੈ ਇਹ ਨਗਰੀ ਨੂੰ ਅਸੀਂ ਦੁੱਖ ਨਿਵਾਰਨ ਸਾਹਿਬ ਦੇ ਨਾਂ ਨਾਲ ਵੀ ਜਾਣਦੇ ਹਾਂ ਅਤੇ ਇੱਥੇ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਖੁਦਵਾ ਕੇ ਸ਼ਹਿਰ ਨੂੰ ਅਬਾਦ ਕੀਤਾ ਸੀ ਅਤੇ ਜੂਨ ਦੋ ਹਜ਼ਾਰ ਛੇ ਨੂੰ ਇਸ ਸ਼ ਜਿਲ੍ਹੇ ਨੂੰ ਜਿਹੜਾ ਵਾ ਜਿਲ੍ਹੇ ਦਾ ਦਰਜਾ ਦਿੱਤਾ ਗਿਆ ਇਸ ਸ਼ਹਿਰ ਨੂੰ ਜਿਹੜਾ ਵਾ ਪਵਿੱਤਰ ਨਗਰੀ ਦਾ ਵੀ ਦਰਜਾ ਹਾਸਿਲ ਹੈ ਅਤੇ ਜਿਹੜਾ ਸ੍ਰੀ ਦਰਬਾਰ ਸਾਹਿਬ ਆ ਤਰਨ ਤਾਰਨ ਰੇਲਵੇ ਸਟੇਸ਼ਨ ਤੋਂ ਇੱਕ ਕਿਲੋਮੀਟਰ 'ਤੇ ਬਸ ਸਟੈਂਡ ਤਰਨ ਤਰਨ ਤੋਂ ਅੱਧਾ ਕਿਲੋਮੀਟਰ ਦੂਰੀ 'ਤੇ ਹੈ ਤਾਂ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਇੱਥੇ ਹੋਰ ਗੁਰਦੁਆਰਾ ਗੁਰੂ ਕਾ ਖੁਹ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਟੱਕਰ ਸਾਹਿਬ ਬੀਬੀ ਭਾਨੀ ਦਾ ਖੂਹ ਅਤੇ ਗੁਰਦੁਆਰਾ ਲਕੀਰ ਸਾਹਿਬ ਆਦਿ ਦੇਖਣ ਯੋਗ ਇੱਥੇ ਸਥਾਨ ਹੈਗੇ ਆ ਅਤੇ ਮੈਂ ਸਵੇਰੇ ਤਰਨਤਾਰਨ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਜਾਂਦੀ ਹਾਂ ਗੁਰਦੁਆਰਾ ਜਾਣਾ ਇੱਕ ਬਹੁਤ ਅ ਅਨੋਖਾ ਜਿਹਾ ਅਨੁਭਵ ਹੁੰਦਾ ਹੈ ਜਿੱਥੇ ਤੁਹਾਨੂੰ ਧਿਆਨ ਅਤੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ ਗੁਰਦੁਆਰੇ ਵਿੱਚ ਜਿਹੜਾ ਵਾ ਕੀਰਤਨ ਅਰਦਾਸ ਅਤੇ ਸੰਗਤ ਦਾ ਮਿਲਾਪ ਤਾਂ ਸਾਨੂੰ ਆਨੰਦ ਦਾ ਅਨੁਭਵ ਕਰਾਉਂਦਾ ਹੈ ਇਸ ਸਥਾਨ 'ਤੇ ਸਾਨੂੰ ਸੁੱਖ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ ਧੰਨਵਾਦ